ਮੈਨੂੰ ਗਲਪ ਅਤੇ ਗੈਰ ਗਲਪ ਦੋਨੋਂ ਹੀ ਲਿਖਣਾ ਪਸੰਦ ਹੈ ਗਲਪ ਦੇ ਵਿੱਚ ਅਸੀਂ ਉਹ ਲਿਖ ਸਕਦੇ ਹਾਂ ਜੋ ਕਰ ਜੋ ਕਿ ਸੰਸਾਰ ਦੇ ਵਿੱਚ ਹੋਇਆ ਹੀ ਨਹੀਂ ਆਪਣੀ ਇੱਕ ਸੋਚ ਹੈ ਅਤੇ ਗੈਰ ਗਲਪ ਦੇ ਵਿੱਚ ਆਪਾਂ ਉਹ ਲਿਖ ਸਕਦੇ ਹਾਂ ਜੋ ਸੰਸਾਰ ਦੇ ਵਿੱਚ ਹੋਇਆ ਹੈ ਆਪਣੇ ਮਨ ਦੇ ਵਿੱਚ ਕਈ ਇੱਦਾਂ ਦੇ ਫੁਰਨੇ ਹੁੰਦੇ ਹਨ ਵੀ ਆਪਾਂ ਨੂੰ ਇਹ ਹੁੰਦਾ ਕਿ ਉਹ ਚੀਜ਼ ਆਪਾਂ ਕਿਸੇ ਅੱਗੇ ਰੱਖ ਸਕੀਏ ਅਤੇ ਉਹ ਚੀਜ਼ ਅਗਰ ਮੈਂ ਲਿਖਣ ਦੀ ਕੋਸ਼ਿਸ਼ ਕਰਾਂ ਤਾਂ ਉਹਨੂੰ ਇੱਕ ਇੱਦਾਂ ਦੇ ਰੂਪ ਦੇ ਵਿੱਚ ਮੈਂ ਭਰੂੰਗਾ ਕਿ ਕਿਸੇ ਦੀ ਸੋਚ ਤੋਂ ਪਰੇ ਹੋਵੇ ਤਾਂ ਕਿ ਜੋ ਉਹ ਕਲਪਨਾ ਹੈ ਉਹ ਕਿਤੇ ਨਾ ਕਿਤੇ ਜਾ ਕੇ ਸ਼ਾਇਦ ਸੱਚ ਹੋ ਜੇ ਅਤੇ ਗੈਰ ਗਲਪ ਦੇ ਵਿੱਚ ਮੈਂ ਉਹ ਚੀਜ਼ਾਂ ਲਿਖਣੀਆਂ ਪਸੰਦ ਕਰਾਂਗਾ ਜੋ ਸੰਸਾਰ ਦੇ ਵਿੱਚ ਸਮਾਜ ਦੇ ਵਿੱਚ ਹੋ ਰਹੀਆਂ ਨੇ ਪਰ ਹਰ ਇਕ ਉਹਨੂੰ ਅਣਦੇਖਾ ਕਰ ਰਿਹਾ ਕਿਸੇ ਨਾਲ ਅੱਤਿਆਚਾਰ ਹੋ ਰਿਹਾ ਕਿਸੇ ਨਾਲ ਮਾੜਾ ਹੋ ਰਿਹਾ ਕੋਈ ਮਾੜਾ ਕਰ ਰਿਹਾ ਦੁਨੀਆਂ ਨੂੰ ਅੱਜ ਕੱਲ੍ਹ ਇਹ ਲੱਗ ਰਿਹਾ ਕਿ ਸਾਨੂੰ ਕੀ ਉਹਦੇ ਨਾਲ ਹੋ ਰਿਹਾ ਪਰ ਕੀ ਪਤਾ ਕੱਲ ਨੂੰ ਉਹ ਸਾਡੇ ਨਾਲ ਵੀ ਹੋ ਸਕੇ ਇਹ ਚੀਜ਼ਾਂ ਨੂੰ ਮੈਂ ਜਿੰਨਾਂ ਵੱਧ ਤੋਂ ਵੱਧ ਵਧੀਆ ਲਿਖਣ ਦੀ ਕੋਸ਼ਿਸ਼ ਕਰ ਸਕਦਾ ਮੈਂ ਕੋਸ਼ਿਸ਼ ਕਰਾਂਗਾ ਤਾਂ ਕਿ ਮੇਰੀਆਂ ਲਿਖੀਆਂ ਹੋਈਆਂ ਚੀਜ਼ਾਂ ਸ਼ਾਇਦ ਮੈਂ ਹੀ ਪੜ੍ਹ ਕੇ ਕੁਝ ਸਮਝ ਪਾਵਾਂ ਕਿਉਂਕਿ ਅਕਸਰ ਇੱਦਾਂ ਹੀ ਹੁੰਦਾ ਕਿ ਇਨਸਾਨ ਆਪ ਦੇ ਅੰਦਰ ਦੇਖਦਾ ਨਹੀਂ ਪਰ ਬਾਹਰ ਦੂਜਿਆਂ ਨੂੰ ਦੇਖਦਾ ਫਿਰਦਾ ਵੀ ਉਹ ਗਲਤ ਹੈ ਉਹ ਇੱਦਾਂ ਬਾਕੀ ਗਲਪ ਗੈਰ ਗਲਪ ਦਾ ਇਹ ਜੋ ਵਿਸ਼ਾ ਇਹ ਮੈਨੂੰ ਵਧੀਆ ਲੱਗਣ ਲੱਗਾ ਇੱਕ ਲਿਖਾਰੀ ਨੇ ਨਾਨਕ ਸਿੰਘ ਜਿਹਨਾਂ ਦਾ ਮੈਂ ਇੱਕ ਨਾਵਲ ਪੜਿਆ ਸੀਗਾ ਪਵਿੱਤਰ ਪਾਪੀ ਜਿਸ ਦੇ ਵਿੱਚ ਸੱਚੀਆਂ ਘਟਨਾਵਾਂ ਨੂੰ ਥੋੜ੍ਹਾ ਜਿਹਾ ਗਲਪ ਦੇ ਨਾਲ ਜੋੜ ਕੇ ਇੱਦਾਂ ਪੇਸ਼ ਕੀਤਾ ਗਿਆ ਕਿ ਉਹਦੇ ਤੋਂ ਮੈਨੂੰ ਇਹ ਸਿੱਖਣ ਨੂੰ ਮਿਲਿਆ ਕਿ ਕਿੱਦਾਂ ਕੋਈ ਇਨਸਾਨ ਕਿੱਦਾਂ ਬਦਲ ਸਕਦਾ ਕਿੱਥੋਂ ਕੀ ਹੋ ਸਕਦਾ ਉਹ ਸਹੀ ਰਸਤੇ 'ਤੇ ਵੀ ਕਿੱਦਾਂ ਆ ਸਕਦਾ